ਸਾਡੇ ਪੰਜਾਬ ਵਿੱਚ ਬਹੁਤ ਸਾਰੀਆਂ ਇਹੇ ਜਿਹੀਆਂ ਕਾਲਜ ਸਕੂਲ ਹਨ ਜੋ ਵੱਖਰੀਆਂ ਵੱਖਰੀਆਂ ਕਲਾ ਦੇ ਪੇਸ਼ ਕਰਦੀਆਂ ਹਨ ਜਿਵੇਂ ਬਠਿੰਡੇ ਵਿੱਚ ਸਪੋਟਸ ਸਤੂਲ ਹੈ ਅਤੇ ਸਪੋਟਸ ਸਤੂਲ ਵਿੱਚ ਬੱਚਿਆਂ ਨੂੰ ਸਪੋਟਸ ਬਾਰੇ ਖੇਡਾਂ ਜਿਵੇਂ ਕਬੱਡੀ ਰੇਸਾਂ ਹੋਰ ਕ੍ਰਿਕਟ ਜੁੱਡੋ ਆਦਿ ਸਿਖਾਈਆਂ ਜਾਂਦੀਆਂ ਹਨ ਆਈ ਆਈ ਬਠਿੰਡੇ ਵਿੱਚ ਆਈ ਟੀ ਆਈ ਸਤੂਲ ਹੈ ਜੋ ਕਿ ਪਲੰਬਰ ਦਾ ਕੰਮ ਸਿਖਾਇਆ ਜਾਂਦਾ ਹੈ ਬੈਲਡੀਨ ਦਾ ਬੈ ਅਤੇ ਬਿਜਲੀ ਦਾ ਅਤੇ ਬਿਜਲੀ ਦਾ ਹੋਰ ਬਹੁਤ ਸਾਰੀਆਂ ਆਈ ਟੀ ਆਈ ਕਰਾਈ ਜਾਂਦੀਆਂ ਜਿਸ ਨਾਲ ਬੱਚਾ ਅਤੇ ਆਪਣਾ ਰੁਜ਼ਗਾਰ ਪੈਦਾ ਹੋ ਜਾਂਦਾ ਹੈ ਇਸ ਸਾਡੇ ਸਾਡੇ ਇੱਥੇ ਐੱਨ ਐੱਨ ਐੱਸ ਸਤੂਲ ਹੈ ਜਿਸ ਵਿੱਚ ਬੱਚਿਆਂ ਨੂੰ ਫ਼ੌਜ ਬਾਰੇ ਫ਼ੌਜ ਬਾਰੇ ਸਮਝਾਇਆ ਜਾਂਦਾ ਹੈ ਜਿਸ ਨਾਲ ਬੱਚਾ ਹੋਰ ਆਪਣੀ ਰੋਟੀ ਰੋਜੀ ਕਮਾਉਣ ਲਈ ਉਹ ਆਪਣੇ ਸਤਾ ਉੱਧਰ ਵੀ ਜਾਂਦੇ ਹਨ ਸਾਡੇ ਸਾਡੇ ਸਮਾਂ ਸਾਡੇ ਬਠਿੰਡੇ ਜਿਲ੍ਹੇ ਵਿੱਚ ਹੋਰ ਚੀਜ਼ਾਂ ਹਨ ਜਿਸ ਨਾਲ ਬੱਚੇ ਨੂੰ ਆਪਣੀ ਰੋ ਰੋਜੀ ਰੋਟੀ ਕਮਾਉਣ ਲਈ ਉਹ ਆਪਣੀ ਸਿੱਖਿਆ ਪ੍ਰਾਪਤ ਕਰਕੇ ਆਪਣੀ ਮੰਜਿਲ 'ਤੇ ਪਹੁੰਚ ਜਾਂਦਾ ਹੈ